ਪਿਛਲੇ ਸਾਲ ਦੇ ਹੜ੍ਹ ਵਿੱਚ ਗਰੀਬ ਘਰਾਂ ਦਾ ਬਹੁਤ ਨੁਕਸਾਨ ਹੋਇਆ ਹੈ ਜਿਸ ਵਿੱਚ ਜਾਨਵਰ ਫਸਲਾਂ ਅਤੇ ਹੋਰ ਕਈ ਐਟਮਾਂ ਆਦਿ ਪੰਜਾਬ ਦਾ ਅਤੇ ਇੰਡੀਆ ਦਾ ਬਹੁਤ ਨੁਕਸਾਨ ਹੋ ਗਿਆ ਜਿਸ ਵਿੱਚ ਬਹੁਤ ਹੀ ਬੰਦੇ ਮਰ ਚੁੱਕੇ ਹਨ ਅਤੇ ਗਰੀਬ ਵਿਅਕਤੀਆਂ ਦੀ ਘਰ ਦਾ ਨੁਕਸਾਨ ਹੋ ਗਿਆ ਮਕਾਨ ਢਹਿ ਗਏ ਗੱਡੀਆਂ ਹੜ੍ਹ ਗਈਆਂ ਹੋਰ ਬਹੁਤ ਐਟਮਾਂ ਜੋ ਦੱਸ ਨਹੀਂ ਹੋ ਸਕਦੀਆਂ ਇਸ ਹੜ੍ਹ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰਿਵਾਰਾਂ ਦੇ ਪਰਿਵਾਰ ਮਰ ਗਏ ਇਸ ਕਰਕੇ ਹੜ੍ਹ ਨੇ ਬਹੁਤ ਹੀ ਨੁਕਸਾਨ ਕੀਤਾ ਆਪਣੇ ਪੰਜਾਬ ਦਾ ਅਤੇ ਇੰਡੀਆ ਦਾ ਅਤੇ ਹੋਰ ਕੰਨਟਰੀਆਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਪਰਿਵਾਰਾਂ ਦੇ ਪਰਿਵਾਰ ਵੀ ਮਰ ਚੁੱਕੇ ਹੈ ਹੋਰ ਬੱਚੇ ਮਰ ਗਏ ਜਾਨਵਰ ਆਦਿ ਫਸਲਾਂ ਹੋਰ ਕਈ ਐਟਮਾਂ ਹੈ ਜਿਹਨਾਂ ਵਿੱਚ ਇਹ ਹੜ੍ਹ ਨੇ ਬਹੁਤ ਨੁਕਸਾਨ ਕੀਤਾ ਸੀ